ਹਾਂਜੀ ਹਾਂਜੀ ਹਾਂਜੀ ਹਾਂਜੀ ਹਰਪ੍ਰੀਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸ਼ਹੀਦੀ ਜੋੜ ਮੇਲਾ ਅੱਜ ਸੰਗਰਾਂਦ ਆ ਇੱਕ ਪੋਹ ਆ ਗਿ ਗਿਆਰ੍ਹਾਂ ਬਾਰ੍ਹਾਂ ਤੇਰ੍ਹਾਂ ਪੋਹ ਜਿਵੇਂ ਛੱਬੀ ਸਤਾਈ ਅਤੇ ਅਠਾਈ ਤਰੀਕ ਬਣਦੀ ਦਸੰਬਰ ਦੀ ਆਜੋ ਆਜੋ ਵੈਲਕਮ ਵੈਲਕਮ ਜੀ ਆਇਆ ਨੂੰ ਮਾਹੌਲ ਮਾਹੌਲ ਤਾਂ ਠੀਕ ਆ ਸਿੱਖ ਇਤਿਹਾਸ ਬਾਰੇ ਵੀ ਤਾਂ ਦੱਸਣਾ ਸਿੱਖ ਇਤਿਹਾਸ ਨਾਲ ਸੰਬੰਧਿਤ ਹੈਗਾ ਸ਼ਹੀਦੀ ਜੋੜ ਮੇਲ ਕਿਹਾ ਜਾਂਦਾ ਇਹਨੂੰ ਬੱਚੇ ਸੀ ਛੋਟੇ ਛੋਟੀਆਂ ਉਮਰਾਂ ਜਿਵੇਂ ਸੱਤ ਸਾਲ ਅਤੇ ਨੌ ਸਾਲ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਉਹਨਾਂ ਨੂੰ ਕਿਸੇ ਗੰਗੂ ਬਾਹਮਣ ਰਸੋਈਆ ਹੁੰਦਾ ਸੀ ਉਥੇ ਪਿੱਛੇ ਉਹ ਕਿਤੇ ਬਰ ਬਰਗਲਾ ਕੇ ਲਿਆਇਆ ਆਪਣੇ ਘਰ ਉੱਥੇ ਜਾ ਕੇ ਉਹਨੇ ਮਰਿੰਡੇ ਕਚਹਿਰੀ 'ਚ ਰਿਪੋਰਟ ਕਰਤੀ ਵੀ ਬੱਚੇ ਮੇਰੇ ਕੋਲ ਨੇ ਕਿਉਂਕਿ ਸਰਕਾਰ ਆ ਜਿਹੜੀ ਮੌਕੇ ਦੀ ਉਹ ਪਿੱਛੇ ਓਹ ਪਈ ਹੋਈ ਸੀ ਸਿੱਖੀ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਉੱਥੇ ਪਰਿਵਾਰ ਵਿਛੋੜੇ ਉੱਥੇ ਪਰਿਵਾਰ ਵਿਛੜ ਗਿਆ ਸੀ ਕੁਛ ਬੱਚੇ ਉਧਰ ਚਮਕੌਰ ਸਾਹਿਬ ਚਲੇ ਗੁਰੂ ਸਾਹਿਬ ਨਾਲ ਅਤੇ ਕੁਛ ਏ ਇੱਧਰ ਨੂੰ ਆ ਗਏ ਤਾਂ ਗੰਗੂ ਮਰਿੰਡੇ ਲੈ ਕੇ ਉਹਨੇ ਫੜਾ ਤੇ ਉਹ ਸੂਬਾ ਸਰਹੰਦ ਕੋਲ ਪੇਸ਼ ਕਰਤੇ ਉਹਨੇ ਆਪਣੇ ਆਪਣੇ ਨਾਮਦਾਰੀ ਲੈਣ ਵਾਸਤੇ ਤਾਂ ਠੰਡਾ ਬੁਰਜ ਪੈਦਾ ਇੱਕ ਠੰਡਾ ਬੁਰਜ ਹੈ ਉਹਦੇ ਵਿੱਚ ਕੈਦ ਰੱਖਿਆ ਇਹਨਾਂ ਨੂੰ ਮਾਤਾ ਗੁਜਰ ਜੀ ਕੌਰ ਜੀ ਨੂੰ ਅਤੇ ਬੱਚਿਆਂ ਨੂੰ ਦੋਵਾਂ ਨੂੰ ਫਿਰ ਦੂਜੇ ਦਿਨ ਕਚਹਿਰੀ ਲੱਗੀ ਕਚਹਿਰੀ ਦੇ ਵਿੱਚ ਜਦ ਪੇਸ਼ ਕੀਤਾ ਇਹਨੂੰ ਕਹਿੰਦੇ ਭਾਈ ਆਪਣਾ ਦੀਨ ਕਬੂਲ ਲਉ ਇਸਲਾਮ ਕਬੂਲ ਲਉ ਤੁਸੀਂ ਮਜ਼ਹਬ ਬਦਲ ਲਉ ਪਰ ਉਹ ਰੱਬੀ ਰੂਹਾਂ ਸੀਗੀਆਂ ਰੱਬ ਨਾਲ ਮਿਲੀਆਂ ਹੋਈਆਂ ਰੂਹਾਂ ਉਹ ਕਿੱਥੇ ਬਦਲਦੀਆਂ ਨੇ ਇਤਿਹਾਸ ਇਤਿਹਾਸ ਰਚ ਤਾ ਉਹਨਾਂ ਨੇ ਉਹ ਕਹਿੰਦੇ ਦੀਨ ਕਬੂਲੇ ਤੁਹਾਡੇ ਸਾਡੀ ਜੁੱਤੀ ਕਹਿੰਦਾ ਤਾਂ ਗੁੱਸਾ ਆ ਗਿਆ ਉਹਨਾਂ ਨੂੰ ਫਿਰ ਬੁਲਾਇਆ ਅੱਗੇ ਸੂਬੇ ਦੇ ਆਪਣਾ ਜਿਹੜੇ ਮੂਹਰਲੇ ਹੁੰਦੇ ਆ ਉਹ ਮਸੰਦਾ ਨੇ ਇਹਨਾਂ ਨੂੰ ਫਿਰ ਫਤਵਾ ਸੁਣਾਓ ਕਹਿੰਦੇ ਜਾਰੀ ਕਰੋ ਫਤਵਾ ਫਿਰ ਉਹ ਫਤਵਾ ਜਾਰੀ ਕਰਤਾ ਵੀ ਇਹਨਾਂ ਨੂੰ ਨੀਹਾਂ 'ਚ ਚਿਣਾਉਣ ਦਾ ਹੁਕਮ ਦਿੱਤਾ ਜਿਉਂਦੇ ਜੀਅ ਹਾਂ